ਮੈਨੂੰ ਟੀ ਵੀ ਦੇਖਣਾ ਬਹੁਤ ਪਸੰਦ ਹੈ ਮੈਂ ਬਹੁਤ ਜ਼ਿਆਦਾ ਟੀ ਵੀ ਦੇਖਦੀ ਹਾਂ ਅਤੇ ਮੈਨੂੰ ਫੋਨ ਚਲਾਉਣਾ ਵੀ ਬਹੁਤ ਪਸੰਦ ਹੈ ਮੈਂ ਟਿਊਸ਼ਨ ਪੜ੍ਹਾਉਂਦੀ ਹਾਂ ਮੈਨੂੰ ਇਹਨਾਂ ਤਿੰਨਾਂ ਕੰਮਾਂ ਨਾਲ਼ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ ਮੈਂ ਚਾਰ ਵਜੇ ਤੋਂ ਲੈ ਕੇ ਸ਼ਾਮ ਨੂੰ ਛੇ ਵਜੇ ਤੱਕ ਟਿਊਸ਼ਨ ਪੜ੍ਹਾਉਂਦੀ ਹਾਂ ਮੇਰੇ ਕੋਲ ਪਲੱਸ ਟੂ ਕਲਾਸ ਤੱਕ ਦੇ ਬੱਚੇ ਆਉਂਦੇ ਹਨ ਮੈਂ ਉਹਨਾਂ ਨੂੰ ਆਲ ਸਬਜੈਕਟ ਪੜ੍ਹਾਉਂਦੀ ਹਾਂ ਬਹੁਤ ਅੱਛੇ ਤਰੀਕੇ ਨਾਲ਼ ਸਾਰੀਆਂ ਚੀਜ਼ਾਂ ਮੈਂ ਉਹਨਾਂ ਨੂੰ ਦੱਸਦੀ ਹਾਂ ਔਰ ਉਸ ਤੋਂ ਬਾਅਦ ਮੈਂ ਟੀ ਵੀ ਦੇ ਵਿੱਚ ਵੀ ਬਹੁਤ ਸਾਰੇ ਸੀਰੀਅਲ ਦੇਖਦੀ ਹਾਂ ਫਿਲਮਾਂ ਦੇਖਦੀ ਹਾਂ ਗਾਣੇ ਸੁਣਦੀ ਹਾਂ ਨਾਟਕ ਜਿਵੇਂ ਕਿ ਮਤਲਬ ਗੀਤ ਢੋਲੀ ਪੰਜਾਬੀ ਨਾਟਕ ਜ਼ਿਆਦਾ ਵਧੀਆ ਲੱਗਦੇ ਆ ਮੈਨੂੰ ਪੰਜਾਬੀ ਫ਼ਿਲਮਾਂ ਵੀ ਵਧੀਆ ਲੱਗਦੀਆਂ ਅਤੇ ਪੰਜਾਬੀ ਨਾਟਕ ਵੀ ਵਧੀਆ ਲੱਗਦੇ ਆ ਪੰਜਾਬੀ ਫਿਲਮਾਂ ਦੇ ਵਿੱਚ ਮੈਨੂੰ ਪੰਜਾਬੀ ਨਾਟਕਾਂ ਦੇ ਵਿੱਚ ਮੈਨੂੰ ਗੀਤ ਢੋਲੀ ਹੋ ਗਿਆ ਨੈਣ ਹੋ ਗਿਆ ਧੀਆਂ ਮੇਰੀਆਂ ਕਦੀ ਕਦੀ ਮੈਂ ਹਿੰਦੀ ਸੀਰੀਅਲ ਵੀ ਦੇਖ ਲੈਂਦੀ ਹਾਂ ਜਿਵੇਂ ਗੁੰਮ ਹੈ ਕਿਸੀ ਕੇ ਪਿਆਰ ਮੇਂ ਇਹ ਸਾਰੇ ਉਸ ਤੋਂ ਬਾਅਦ ਮੈਂ ਫ਼ੋਨ ਵੀ ਚਲਾਉਂਦੀ ਹਾਂ ਫ਼ੋਨ ਦੇ ਵਿੱਚ ਮੈਨੂੰ ਇੰਸਟਾਗ੍ਰਾਮ ਰੀਲਸ ਦੇਖਣੀਆਂ ਬਹੁਤ ਪਸੰਦ ਹੈ ਅਤੇ ਫੇਸਬੁੱਕ 'ਤੇ ਫੇਸਬੁੱਕ ਵੀ ਦੇਖ ਲੈਂਦੀ ਹਾਂ ਉਸ ਤੋਂ ਬਾਅਦ ਯੂਟਿਊਬ 'ਤੇ ਮੈਨੂੰ ਖਾਣੇ ਵਾਲੀ ਵੀਡੀਓਜ਼ ਬਹੁਤ ਪਸੰਦ ਹੈ ਦੇਖਣਾ ਸਭ ਤੋਂ ਜ਼ਿਆਦਾ ਮੈਨੂੰ ਚਾਈਨੀਜ਼ ਜੋ ਖਾਂਦੇ ਆ ਨਾ ਉਹਨਾਂ ਦੀ ਆਵਾਜ਼ ਮਤਲਬ ਕਿਸ ਤਰ੍ਹਾਂ ਖਾਂਦੇ ਆ ਉਹ ਕਿਵੇਂ ਇਹ ਸਭ ਕੁੱਝ ਮਤਲਬ ਉਹ ਮਤਲਬ ਖਾਣੇ ਦਾ ਤਰੀਕਾ ਕਿਵੇਂ ਦਾ ਏ ਉਹਨਾਂ ਦਾ ਮੈਨੂੰ ਉਹ ਬਹੁਤ ਪਸੰਦ ਆਉਂਦਾ ਏ